ਸਤਿ ਸ਼੍ਰੀ ਅਕਾਲ ਸਰ ਮੈਂ ਜਪਨੀਤ ਕੌਰ ਰਿਆਤ ਕੋਲਿਜ ਔਫ ਲੋਅ ਤੋਂ ਗੱਲ ਕਰ ਰਹੀ ਹਾਂ ਅਸੀਂ ਤੁਹਾਡੀ ਟਰਾਂਸਪੋਰਟ ਕੰਪਨੀ ਦੀ ਦੀਆਂ ਦੋ ਬੱਸਾਂ ਆਪਣੀ ਕੋਲਿਜ ਤੋਂ ਰਾਜਸਥਾਨ ਤੱਕ ਦੀ ਟਰਿੱਪ ਲਈ ਬੁੱਕ ਕੀਤੀਆਂ ਸਨ ਬਟ ਅਸੀਂ ਤੁਹਾਡੀ ਜੋ ਅ ਸਰਵਿਸ ਹੈ ਉਸ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ ਅਸੀਂ ਕੋਲਿਜ ਤੋਂ ਹਜੇ ਨਿਕਲੇ ਹੀ ਸੀ ਕਿ ਬੱਚਿਆਂ ਨੇ ਸੀਟਾਂ ਦੇਖੀਆਂ ਸੀਟਾਂ ਦੀ ਹਾਲਤ ਬਹੁਤ ਖਰਾਬ ਸੀ ਅਸੀਂ ਇਸ ਗੱਲ ਨੂੰ ਇਗਨੋਰ ਕਰਦੇ ਹੋਏ ਆਪਣੀ ਟਰਿੱਪ ਸ਼ੁਰੂ ਕੀਤੀ ਬਟ ਸਾਰਾ ਰਸਤਾ ਜੋ ਹੈ ਉਹ ਡਰਾਈਵਰ ਨੇ ਬਹੁਤ ਹੀ ਰੈਸ਼ ਤਰੀਕੇ ਨਾਲ ਕਾ ਆਪਣੀ ਜੋ ਬੱਸ ਹੈ ਉਹ ਚਲਾਈ ਹੈ ਜਿਸ ਨਾਲ ਐਕਸੀਡੈਂਟ ਹੋਣ ਦਾ ਖਤਰਾ ਵੀ ਵੱਧ ਰਿਹਾ ਹੈ ਸਾਰੇ ਬੱਚਿਆਂ ਦੀ ਜਾਨ ਦੀ ਜ਼ਿੰਮੇਵਾਰੀ ਸਾਡੇ ਸਿਰ 'ਤੇ ਹੈ ਅਸੀਂ ਇਸ ਤਰ੍ਹਾਂ ਦਾ ਰਿਸਕ ਨਹੀਂ ਲੈ ਸਕਦੇ ਅਤੇ ਚੰਡੀਗੜ੍ਹ ਨੇੜੇ ਪਹੁੰਚਦੇ ਹੀ ਤੁਹਾਡੀ ਇੱਕ ਬੱਸ ਜੋ ਹੈ ਉਹ ਪੰਚਰ ਹੋ ਗਈ ਹੈ ਅਤੇ ਡਰਾਈਵਰ ਇਸਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲੈ ਰਿਹਾ ਅਸੀਂ ਉਸਨੂੰ ਬਾਰ ਬਾਰ ਕਹਿ ਰਹੇ ਹਾਂ ਕਿ ਕਿਸੇ ਮਕੈਨਿਕ ਨੂੰ ਬੁਲਾਓ ਜਾਂ ਫਿਰ ਇਸ ਬੱਸ ਦੀ ਜਗ੍ਹਾ ਆਪਣੀ ਟਰਾਂਸਪੋਰਟ ਕੰਪਨੀ ਤੋਂ ਕੋਈ ਦੂਸਰੀ ਬੱਸ ਮੰਗਵਾਓ ਬਟ ਉਹ ਕੁਛ ਕਰ ਹੀ ਨਹੀਂ ਰਿਹਾ ਸਾਡਾ ਅੱਗੇ ਦਾ ਪੂਰਾ ਪਲੈਨ ਹੈ ਉੱਥੇ ਪਹੁੰਚਣਾ ਏ ਅਸੀਂ ਟਾਈਮ ਨਾਲ 'ਤੇ ਅਲੱਗ ਅਲੱਗ ਜਗ੍ਹਾ ਘੁੰਮਣਾ ਹੈ ਤੁਸੀਂ ਸਾਡੀ ਸਾਰੀ ਟਰਿੱਪ ਖਰਾਬ ਕਰ ਰਹੇ ਹੋ ਸਰ ਇਸ ਤਰ੍ਹਾਂ ਦੀ ਸਰਵਿਸ ਜੋ ਹੈ ਉਹ ਤੁਹਾਡੇ ਤੋਂ ਅਸੀਂ ਨਹੀਂ ਸੋਚੀ ਸੀ ਅਸੀਂ ਹਰ ਸਾਲ ਤੁਹਾਡੇ ਹੀ ਟ੍ਰਾਂਸਪੋਰਟ ਕੰਪਨੀ ਦੀਆਂ ਬੱਸਿਜ਼ ਆਪਣੀ ਟਰਿੱਪ 'ਤੇ ਲੈ ਕੇ ਜਾਂਦੇ ਹਾਂ ਬਟ ਇਸ ਵਾਰ ਤੁਹਾਡੀ ਜੋ ਸੇਵਾ ਏ ਉਹ ਬੜੀ ਨਿਰਾਸ਼ਾਜਨਕ ਸੀ ਇਹ ਚੰਗੀ ਗੱਲ ਨਹੀਂ ਹੈ ਸਰ ਅਸੀਂ ਆਪਣੀ ਜੋ ਪੇਮੈਂਟ ਹੈ ਉਹ ਵੀ ਤੁਹਾਨੂੰ ਐਡਵਾਂਸ ਵਿੱਚ ਕੀਤੀ ਸੀਗੀ ਜਿਸ ਅਸੀਂ ਸੋਚਿਆ ਸੀ ਕਿ ਤੁਸੀਂ ਚੰਗੀ ਸੇਵਾ ਦੋਉਂਗੇ ਅਤੇ ਇੱਕ ਚੰਗੀ ਡੀਲਕਸ ਬੱਸ ਸਾਨੂੰ ਦੋਉਂਗੇ ਬਟ ਤੁਸੀਂ ਤਾਂ ਬਿਲਕੁਲ ਹੀ ਇੱਕ ਖਰਾਬ ਅਤੇ ਖਟਾਰਾ ਬੱਸ ਭੇਜੀ ਹੈ ਜਿਸ ਕਾਰਨ ਸਾਰੇ ਬੱਚਿਆਂ ਦੇ ਟਰਿੱਪ ਦਾ ਮਜ਼ਾ ਹੀ ਖਰਾਬ ਹੋ ਗਿਆ ਹੈ ਅਤੇ ਸਾਨੂੰ ਅੱਧਾ ਘੰਟਾ ਹੋ ਗਿਆ ਹੈ ਇੱਥੇ ਖੜ੍ਹਿਆਂ ਨੂੰ ਕੋਈ ਵੀ ਮਕੈਨਿਕ ਨਹੀਂ ਆ ਰਿਹਾ ਤੁਸੀਂ ਜਲਦ ਤੋਂ ਜਲਦ ਜਾਂ ਕਿਸੇ ਮਕੈਨਿਕ ਦਾ ਪ੍ਰਬੰਧ ਕਰੋ ਜਾਂ ਫਿਰ ਇੱਕ ਨਵੀਂ ਬੱਸ ਭੇਜੋ ਜਿਸ ਨਾਲ ਅਸੀਂ ਆਪਣਾ ਟਰਿੱਪ ਜੋ ਹੈ ਉਹ ਅੱਗੇ ਪਹੁੰਚ ਸਕੀਏ ਇੰਨਾਂ ਲੰਬਾ ਰਸਤਾ ਹੈ ਇੰਨੀ ਖਟਾਰਾ ਬੱਸ ਦੇ ਵਿੱਚ ਬੱਚੇ ਕਿਵੇਂ ਜਾਣਗੇ ਸਰ ਅਗਰ ਅਸੀਂ ਪੇਮੈਂਟ ਕੀਤੀ ਹੋਈ ਹੈ ਤੁਹਾਨੂੰ ਇਹ ਤਾਂ ਧਿਆਨ ਰੱਖਣਾ ਚਾਹੀਦਾ ਹੈ ਨਾ ਕਿ ਜਿੰਨੀ ਅਸੀਂ ਪੇਮੈਂਟ ਕੀਤੀ ਹੈ ਉਸ ਹਿਸਾਬ ਦੀ ਤੁਸੀਂ ਸੇਵਾ ਵੀ ਪ੍ਰਬੰਧ ਕਰੋ ਇਹ ਬੜੀ ਨਿਰਾਸ਼ਾਜਨਕ ਸਰਵਿਸ ਸੀ